ਹਾਂਜੀ ਮੈਨੂੰ ਲਿਖਣ ਦੀ ਰੂਟੀਨ ਹੈ ਅਤੇ ਮੈਂ ਇਸਦੀ ਪਾਲਨਾ ਕਰਦਾ ਹਾਂ ਮੈਨੂੰ ਲਿਖਣਾ ਬਹੁਤ ਪਸੰਦ ਹੈ ਮੇਰੀ ਲਿਖਣ ਵਿੱਚ ਬਹੁਤ ਰੁਚੀ ਹੈ ਮੈਨੂੰ ਜਦੇ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਮਿਨ ਮੈਂ ਕੁਛ ਨਾ ਕੁਛ ਲਿਖ ਲੈਂਦਾ ਹਾਂ ਤੁਸੀਂ ਮੈਂ ਲਿਖਣ ਵਿੱਚ ਅਨੁਸ਼ਾਸਨ ਬਣਾਉਣ ਲਈ ਕਈ ਤਰੀਕੇ ਅਪਣਾਉਂਦਾ ਹਾਂ ਜੋ ਕਿ ਇੱਕ ਤਾਂ ਹੈ ਕਿ ਨਿਯਮਤ ਸਮੇਂ 'ਤੇ ਲਿਖਣਾ ਮੈਂ ਤੁਹਾਨੂੰ ਇੱਕ ਲਿਖਣ ਦਾ ਸਹੀ ਸਮਾਂ ਵੀ ਨਿਰਧਾਰਿਤ ਕਰਨਾ ਚਾਹੁੰਦਾ ਹੈ ਜਿਸ ਸਮੇਂ ਤੁਹਾਨੂੰ ਸ਼ੁੱਧ ਵਿਚਾਰ ਆਉਣ ਤੁਸੀਂ ਸਵੇਰ ਦੇ ਸਮੇਂ ਸ਼ਾਮ ਦੇ ਸਮੇਂ ਦੁਪਹਿਰ ਦੇ ਸਮੇਂ ਜਦੋਂ ਵੀ ਤੁਹਾਡੇ ਦਿਮਾਗ ਵਾਸਤੇ ਚੰਗਾ ਲੱਗਦਾ ਹੋਵੇ ਉਸ ਸਮੇਂ ਲਿਖੋ ਮੈਨੂੰ ਸ਼ਾਮ ਦਾ ਸਮਾਂ ਚੰਗਾ ਲੱਗਦਾ ਹੈ ਤਾਂ ਮੈਂ ਸ਼ਾਮ ਦੇ ਸਮੇਂ ਲਿਖਦਾ ਹਾਂ ਲਿਖਣ ਲਈ ਕਿ ਥੋਹ ਤੁਹਾਨੂੰ ਮਾਹੌਲ ਵੀ ਵਧੀਆਂ ਬਣਾਉਣਾ ਚਾ ਚਾਹੀਦਾ ਹੈ ਤੁਸੀਂ ਲਿਖਣ ਵ ਵਾਸਤੇ ਇੱਕ ਸ਼ਾਂਤ ਵਾਤਾਵਰਣ ਵਿੱਚ ਜਾ ਕੇ ਲਿਖੋ ਤੁਸੀਂ ਆਪਣੀ ਕੋਈ ਵਧੀਆ ਥਾਂ ਜਿਵੇਂ ਪਾਰਕ ਮੈਦਾਨ ਕਮਰੇ ਡਰਾ ਡਰਾਇੰਗ ਰੂਮ ਵਿਚ ਬੈਠ ਕੇ ਵੀ ਲਿਖ ਸਕਦੇ ਹੋ ਤੁਹਾਨੂੰ ਮੈਂ ਲਿਖਣ ਵਾਸਤੇ ਆਪਣੀ ਜੇਬ ਵਿੱਚ ਇੱਕ ਨੋਟਬੁੱਕ ਯਾ ਜਾਂ ਫੋਨ ਵਿੱਚ ਨੋਟਪੈਡ ਉੱਤੇ ਲਿਖ ਲੈਂਦਾ ਹਾਂ ਮੇਰੀ ਆਦਤ ਹੈ ਕਿ ਮੈਂ ਲਿਖਣ ਤੋਂ ਪਹਿਲਾਂ ਮੈਂ ਲਿਖਣ ਤੋਂ ਪਹਿਲਾਂ ਪਹਿਲਾ ਸੋਚ ਕੇ ਲਿਖਦਾ ਹਾਂ ਫਿਰ ਦੁਬਾਰਾ ਉਸਨੂੰ ਪੜ੍ਹਦਾ ਹਾਂ ਫਿਰ ਦੁਬਾਰਾਂ ਲਿਖਦਾ ਹਾਂ ਅਗਰ ਤੁਹਾਨੂੰ ਲਿਖਣ ਵਿੱਚ ਅਨੁਸ਼ਾਸਨ ਬਣਾਉਣਾ ਚਾਹੀਦਾ ਰੱਖਣਾ ਪੈਂਦ ਰੱਖਣਾ ਹੈ ਤਾਂ ਤੁਸੀਂ ਇਹ ਤਰੀਕੇ ਅਪਣਾ ਸਕਦੇ ਹਨ ਮੈਨੂੰ ਇਸ ਨਾਲ ਬਹੁਤ ਵਧੀਆ ਲੱਗਦਾ ਹੈ ਅਤੇ ਲਿਖਣ ਦੀ ਆਦਤ ਨੂੰ ਮੈਂ ਇਸ ਤਰ੍ਹਾਂ ਹੀ ਜਾਰੀ ਰੱਖਣਾ ਚਾਹੁੰਦਾ ਹਾਂ